ਇੰਸਪੈਕਟਰ ਸਰ ਮੈਂ ਬਹੁਤ ਹੀ ਦੁਖੀ ਹਿਰਦੇ ਨਾਲ ਗੱਲ ਕਰ ਰਹੀ ਹਾਂ ਕਿ ਮੇਰੇ ਪਿਤਾ ਜੀ ਸੋਲ੍ਹਾਂ ਅਗਸਤ ਨੂੰ ਉਹਨਾਂ ਦੀ ਡੈਥ ਹੋ ਗਈ ਸੀ ਪਰ ਉਹਨਾਂ ਦਾ ਜਿਹੜੇ ਡਾਕੂਮੈਂਟ ਬਣੇ ਸੀ ਜਿਹੜਾ ਉਹਨਾਂ ਦਾ ਡੈਥ ਸਰਟੀਫਿਕੇਟ ਬਣਿਆ ਉਹਨਾਂ ਦੇ ਸਰਟੀਫਿਕੇਟ ਵਿੱਚ ਨਾਮ ਦੀ ਗਲਤੀ ਹੋ ਗਈ ਆ ਅਤੇ ਉਹਨਾਂ ਦੇ ਰਿਗਾਰਡਿੰਗ ਮੈਂ ਉਹਨਾਂ ਦਾ ਨਾਮ ਸਹੀ ਕਰਵਾਉਣਾ ਚਾਹੁੰਦੀ ਹਾਂ ਜਿ ਜਿਹਦੇ ਕਰਕੇ ਮੈਨੂੰ ਅੱਗੇ ਆਉਣ ਵਾਲੇ ਸਮੇਂ 'ਚ ਕੋਈ ਮੁਸ਼ਕਲ ਨਾ ਆਵੇ ਫੈਮਲੀ ਪ੍ਰੋਪਰਟੀ ਹੋਵੇਗੀ ਮੇਰੇ ਪਿਤਾ ਜੀ ਗਵਰਮੈਂਟ ਜੋਬ 'ਤੇ ਸੀ ਅਤੇ ਉਹਨਾਂ ਦੇ ਕਰਕੇ ਜਿਹੜੀ ਉਹਨਾਂ ਦੀ ਪੈਨਸ਼ਨ ਆਉਂਦੀ ਸੀ ਉਹ ਮਦਰ ਨੂੰ ਮਿਲਣ ਲੱਗ ਸਕੇ ਪ੍ਰੋਪਰਟੀ ਵਿੱਚ ਵੀ ਫੈਮਲੀ ਪ੍ਰੋਪਰਟੀ ਵਿੱਚ ਅੱਗੇ ਜਾ ਕੇ ਕੋਈ ਵੀ ਮੁਸ਼ਕਲ ਨਾ ਆਵੇ ਇਸ ਲਈ ਉਹ ਇਸ ਲਈ ਮੈਂ ਚਾਹੁੰਦੀ ਹਾਂ ਕਿ ਇਹ ਕੰਮ ਮੇਰਾ ਜਲਦੀ ਤੋਂ ਜਲਦੀ ਕੀਤਾ ਜਾਵੇ ਮੈਂ ਆਪ ਜੀ ਦੀ ਵੀ ਬਹੁਤ ਧੰਨਵਾਦੀ ਹੋਵਾਂਗੀ ਮੇਰੇ ਪਿਤਾ ਜੀ ਦੀ ਡੈਥ ਕੈਂਸਰ ਕਰਕੇ ਹੋ ਗਈ ਸੀ ਉਹਨਾਂ ਨੂੰ ਹਸਪਤਾਲ ਲੈ ਕੇ ਗਏ ਕਾਫੀ ਟਾਈਮ ਤੋਂ ਬਿਮਾਰ ਸੀ ਅਸੀਂ ਬਹੁਤ ਚੰਗੇ ਚੰਗੇ ਡਾਕਟਰ ਨੂੰ ਵਿਖਾਇਆ ਵੀ ਤਾਂ ਜੋ ਉਹ ਇਸ ਬਿਮਾਰੀ ਤੋਂ ਛੁਟਕਾਰਾ ਪਾ ਸਕਣ ਪਰ ਪਰ ਉਹਨਾਂ ਨੂੰ ਇਹ ਬਿਮਾਰੀ ਤੋ ਛੁਟਕਾ ਛੁਟਕਾਰਾ ਨਹੀਂ ਮਿਲ ਸਕਿਆ ਐਂਡ ਦੇ ਉਹ ਐਂਡ ਆਫ ਡੇਅ ਤੱਕ ਪਰ ਉਹਨਾਂ ਨੂੰ ਕੋਈ ਬਚਾ ਨਾ ਸਕਿਆ ਅਸੀਂ ਬਹੁਤ ਦੂਰ ਦੂਰ ਤੱਕ ਲੈ ਕੇ ਗਏ ਪਰ ਅਸੀਂ ਆਪਣਾ ਸਾਰਾ ਜੋਰ ਲਗਾਇਆ ਸਰ ਮੇਰੇ ਪਿਤਾ ਜੀ ਨਹੀਂ ਬਚ ਸਕੇ ਇਸ ਲਈ ਮੈਂ ਚਾਹੁੰਦੀ ਹਾਂ ਕਿ ਵੀ ਇਹ ਨਾਮ ਜਲਦੀ ਤੋਂ ਜਲਦੀ ਸਹੀ ਕੀਤਾ ਜਾਵੇ ਅਤੇ ਅੱਗੇ ਜਾ ਕੇ ਸਾਨੂੰ ਕੋਈ ਮੁਸ਼ਕਲ ਨਾ ਆਵੇ ਮੇਰੇ ਪਿਤਾ ਜੀ ਦੇ ਜਾਣ ਮਗਰੋਂ ਸਾਡੇ ਪਰਿਵਾਰ ਦੀ ਦਬ ਕੋਈ ਦੁੱਖ ਦਾ ਕੋਈ ਹਾਲਤ ਨਹੀਂ ਰਿਹਾ ਸਾਡਾ ਪਰਿਵਾਰ ਵੀ ਬਹੁਤ ਹੀ ਸਦਮੇ ਵਿੱਚ ਆ ਇਸ ਕਰਕੇ ਪਲੀਜ਼ ਜਲਦੀ ਤੋਂ ਜਲਦੀ ਸਹੀ ਕੀਤਾ ਜਾਵੇ ਮੈਂ ਆਪ ਜੀ ਦੀ ਬਹੁਤ ਧੰਨਵਾਦੀ ਹੋਵਾਂਗੀ